ਅਸੀਂ ਆਪਣੇ ਘਰ ਵਿੱਚ ਵੰਨ ਸੁਵੰਨੇ ਪੌਦੇ ਅਤੇ ਵੇਲਾਂ ਉਗਾਉਂਦੇ ਹਾਂ ਮੈਂ ਆਪਣੇ ਘਰ ਵਿੱਚ ਟਾਹਲੀ ਧਰੇਕ ਅਮਰੂਦ ਅੰਬ ਸਫੈਦਾ ਪਿੱਪਲ ਦਾ ਪੌਦਾ ਲਗਾਇਆ ਹੈ ਅਤੇ ਵੇਲਾਂ ਵਿੱਚ ਕਰੇਲੇ ਦੀ ਵੇਲ ਚੱਪਣ ਕੱਦੂ ਦੀ ਵੇਲ ਘੀਆ ਤੋਰੀ ਦੀ ਵੇਲ ਫਲੀਆਂ ਦੀ ਵੇਲ ਅਤੇ ਦੇਸੀ ਕੱਦੂਆਂ ਦੀ ਵੇਲ ਲਗਾਈ ਹੋਈ ਹੈ ਅਤੇ ਗੁਲਾਬ ਦੇ ਫੁੱਲ ਜੈਸਮੀਨ ਦੇ ਫੁੱਲ ਗੈਂਦੇ ਦੇ ਫੁੱਲ ਦੁਪਹਿਰ ਬੂਟੀ ਦੇ ਫੁੱਲ ਲਗਾਏ ਹੋਏ ਹਨ ਮੈਂ ਇਹਨਾਂ ਦੀ ਦੇਖਭਾਲ ਬਹੁਤ ਵਧੀਆ ਤਰੀਕੇ ਨਾਲ ਕਰਕੇ ਟਾਈਮ ਟਾਈਮ ਸਿਰ ਖਾਦਾਂ ਦਵਾਈਆਂ ਪਾ ਕੇ ਕਰਦੀ ਹਾਂ